ਸਤਿ ਸ਼੍ਰੀ ਅਕਾਲ ਜੀ ਕੁਝ ਪ੍ਰਸਿੱਧ ਬਾਹਰਲੀ ਗਤੀਵਿਧੀਆਂ ਜਾਂ ਖੇਡਾਂ ਕਿਹੜੀਆਂ ਹਨ ਜਿਨ੍ਹਾਂ ਵਿੱਚ ਸੈਲਾਨੀ ਪੰਜਾਬ ਵਿੱਚ ਆਉਣ ਵੇਲੇ ਹਿੱਸਾ ਲੈ ਸਕਦੇ ਹਾਂ ਸਾਡੇ ਪੰਜਾਬ ਵਿੱਚ ਬਹੁਤ ਹੀ ਸਾਰੀਆਂ ਖੇਡਾਂ ਹਨ ਜਿਹਦੇ ਵਿੱਚ ਪੰਜਾਬ ਦੇ ਲੋਕ ਅਤੇ ਬਾਹਰਲੀ ਗਤੀਵਿਧੀਆਂ ਵੀ ਹਿੱਸਾ ਲੈ ਸਕਦੀਆਂ ਹਨ ਜਿਵੇਂ ਕਿ ਕਬੱਡੀ ਕਬੱਡੀ ਦੇ ਵਿੱਚ ਵੀ ਬਾਹਰਲੀਆਂ ਗਤੀਆਂ ਵਿਧੀਆਂ ਆਣ ਕੇ ਹਿੱਸਾ ਲੈ ਸਕਦੀਆਂ ਹਨ ਅਟਾਰੀ ਵਾਹਗਾ ਬੋਡਰ ਵੀ ਗੁਰਦੁਆਰਾ ਜੀ ਜਿਵੇਂ ਕਿ ਗੱਲ ਕੀਤੀ ਜਾਵੇ ਗਤੀਵਿਧੀਆਂ ਜਦੋਂ ਵੀ ਆਉਂਦੇ ਹਨ ਉਹ ਵਾਹਗਾ ਬਾਰਡਰ ਦਾ ਆਨੰਦ ਮਾਣ ਸਕਦੇ ਹਨ ਵਾਹਗਾ ਬਾਰਡਰ 'ਤੇ ਜਾ ਕੇ ਉਹ ਬਹੁਤ ਕੁਛ ਦੇਖਦੇ ਹਨ ਜਿਵੇਂ ਕਿ ਵਾਹਗਾ ਬਾਰਡਰ 'ਤੇ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਹੈ ਜਿਵੇਂ ਕਿ ਇੱਧਰ ਇੰਡੀਆ ਦੀ ਹੁੰਦੀ ਹੈ ਅਤੇ ਉੱਧਰ ਪਾਕਿਸਤਾਨ ਦੀ ਟੀਮ ਹੁੰਦੀ ਹੈ ਦੋਵੇਂ ਇੱਕ ਦੂਸਰੇ ਨੂੰ ਲਲਕਾਰਾ ਦਿੰਦੇ ਹਨ ਜਿਹਦੇ ਕਰਕੇ ਸਾਨੂੰ ਇੰਡੀਅਨ ਹੋਣ ਦਾ ਗਰਵ ਮਹਿਸੂਸ ਹੁੰਦਾ ਹੈ ਅਤੇ ਬੋਡਰ 'ਤੇ ਅਸੀਂ ਜਾ ਸਕੇ ਅਤੇ ਦੂਸਰੀ ਚੀਜ਼ ਜਿਵੇਂ ਅਸੀਂ ਸੋਚ ਸਕਦੇ ਹਾਂ ਹਾਈਕਿੰਗ ਟਰੈਕ ਜਿਵੇਂ ਕਿ ਸ ਕੋਈ ਸ ਬਾਹਰਲੀ ਗਤੀਵਿਧੀਆਂ ਆਉਂਦੇ ਹਨ ਉਹਨਾਂ ਨੂੰ ਅਸੀਂ ਅਪ ਹਰ ਆਪਣੀ ਹਰ ਚੀਜ਼ਾਂ ਦੇ ਵਿੱਚ ਸ਼ਾਮਿਲ ਕਰ ਸਕਦੇ ਹਨ ਕਬੱਡੀ ਦਾ ਮੈਚ ਵੀ ਗਤੀਵਿਧੀਆਂ ਖੇਡ ਸਕਦੀਆਂ ਹਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੰਜਾਬ ਦੇ ਲੋਕ ਹੀ ਖੇਡ ਸਕਦੇ ਹਨ ਇਵੇਂ ਹੀ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜੋ ਕਿ ਬਾਹਰਲੇ ਗਤੀਵਿਧੀਆਂ ਵੀ ਹਿੱਸਾ ਲੈ ਸਕਦੇ ਹਨ ਅਤੇ ਉਹਨਾਂ ਦਾ ਆਨੰਦ ਮਾਣ ਸਕਦੇ ਹਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੰਜਾਬ ਦੀਆਂ ਖੇਡਾਂ ਪੰਜਾਬ ਦੇ ਲੋਕ ਹੀ ਖੇਡਣ ਪੰਜਾਬ ਦੇ ਲੋਕ ਬਾਹਰਲੇ ਗਤੀਵਿਧੀਆਂ ਨੂੰ ਵੀ ਪੁੱਛ ਸਕਦੇ ਹਨ ਕਿ ਜੇਕਰ ਉਹ ਖੇਡਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੀ ਖੇਡਾਂ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਖੇਡਾਂ ਦਾ ਆਨੰਦ ਦੇ ਸਕਦੇ ਹਨ ਧੰਨਵਾਦ ਜੀ